ਪਸ਼ੂ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਮਤਲਬ ਕਿ ਮੈਂ ਇਹ ਕਹਾਂਗੀ ਕਿ ਸਭ ਤੋਂ ਪਹਿਲਾਂ ਆਪਣੀ ਆਰਥਿਕ ਸਥਿਤੀ ਹੈ ਜਿਹੜੀ ਉਹ ਬਹੁਤ ਹੀ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਰਥਿਕ ਸਥਿਤੀ ਵਧੀਆ ਹੋਵੇਗੀ ਤਾਂ ਆਪਾਂ ਇੱਕ ਵੱਡੇ ਪੱਧਰ 'ਤੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਾਂਗੇ ਅਤੇ ਵਧੀਆ ਕੁਆਲਿਟੀ ਦੇ ਉਹਦੇ ਵਿੱਚ ਆਪਾਂ ਪਸ਼ੂ ਲਿਆ ਸਕਾਂਗੇ ਕਿਉਂਕਿ ਅੱਜ ਕੱਲ੍ਹ ਜੇ ਕੋਈ ਵੀ ਕੰਮ ਕਰਦੇ ਹੈ ਤਾਂ ਹਰ ਕੋਈ ਅੱਜ ਕੱਲ੍ਹ ਕੁਆਲਿਟੀ ਦੇਖਦਾ ਠੀਕ ਹੈ ਤਾਂ ਇਸ ਲਈ ਇਹ ਨਹੀਂ ਹੈ ਕਿ ਆਪਾਂ ਕੁਛ ਵੀ ਉਹਦੇ ਵਿੱਚ ਗਲਤ ਨਕਲੀ ਕੰਮ ਕਰੀਏ ਤਾਂ ਕੁਆਲਿਟੀ ਵਾਈਜ਼ ਕੰਮ ਕਰਨ ਵਾਸਤੇ ਪਸ਼ੂ ਪਾਲਣ ਦਾ ਸ਼ੁਰੂ ਕਰਨ ਵਾਸਤੇ ਸਭ ਤੋਂ ਪਹਿਲਾਂ ਆਰਥਿਕ ਸਥਿਤੀ ਹੈ ਜਿਹੜੀ ਉਹ ਬਹੁਤ ਵਧੀਆ ਹੋਣੀ ਚਾਹੀਦੀ ਹੈ ਦੂਜੇ ਨੰਬਰ 'ਤੇ ਮੈਂ ਇਹਨਾਂ ਇਹ ਕਹਿਣਾ ਚਾਹਾਂਗੀ ਕਿ ਸਾਡੇ ਖੇਤਰ ਵਿੱਚ ਬਹੁਤ ਸਾਰੇ ਪਸ਼ੂਆਂ ਨੂੰ ਪਾਲਿਆ ਜਾਂਦਾ ਹੈ ਜਿਵੇਂ ਕਿ ਮੱਜਾਂ ਗਾਵਾਂ ਬੱਕਰੀਆਂ ਮੁਰਗੇ ਮੁਰਗੀਆਂ ਭੇਡਾਂ ਅਤੇ ਹੋਰ ਵੀ ਬਹੁਤ ਸਾਰੇ ਪਸ਼ੂ ਹੈ ਜਿਹੜੇ ਉਹ ਪਾਲੇ ਜਾਂਦੇ ਆ ਸਾਡੇ ਖੇਤਰ ਵਿੱਚ